ਹਾਂਜੀ ਅਸੀਂ ਆਪਣੇ ਮਹਿਮਾਨਾਂ ਨਾਲ ਬਹੁਤ ਹੀ ਵਧੀਆ ਢੰਗ ਨਾਲ ਮੈਂ ਪੇਸ਼ ਆਉਦੀ ਹਾਂ ਜਦੋਂ ਵੀ ਕੋਈ ਸਾਡੇ ਘਰ ਮਹਿਮਾਨ ਆ ਜਾਂਦਾ ਮੈਨੂੰ ਬਹੁਤ ਹੀ ਚਾਅ ਹੁੰਦਾ ਵੀ ਸਾਡੇ ਘਰ ਅੱਜ ਕੋਈ ਮਹਿਮਾਨ ਆਇਆ ਵਾ ਅਸੀਂ ਉਹਨਾਂ ਦੀ ਬਹੁਤ ਹੀ ਬਹੁਤ ਹੀ ਕੇਅਰ ਕਰਦੀ ਹਾਂ ਮਤਲਬ ਕਿ ਉਹ ਨੂੰ ਹਰੇਕ ਚੀਜ਼ ਦੇਈ ਦੀ ਵੇਖੀ ਦੀ ਵੀ ਮਹਿਮਾਨ ਨੂੰ ਕਿਹੜੀ ਚੀਜ਼ ਦੀ ਲੋੜ ਆ ਕ ਕੀ ਚਾਹੀਦਾ ਵਾ ਮਹਿਮਾਨ ਦਾ ਪੂਰਾ ਖਿਆਲ ਰੱਖੀਦਾ ਵਾ ਵੀ ਉਸ ਨੂੰ ਕੋਈ ਦਿੱਕਤ ਨਾ ਆਵੇ ਵੀ ਮੈਂ ਕਿਸ ਜਗ੍ਹਾ 'ਤੇ ਆਇਆ ਹਾਂ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਵੀ ਕੋਈ ਅੱਜ ਸਾਡੇ ਘਰ ਮਹਿਮਾਨ ਆਇਆ ਵਾ ਕੋਈ ਇਹ ਮਤ ਮਹਿਮਾਨ ਆਉਣ ਦੇ ਨਾਲ ਹਰੇਕ ਨੂੰ ਹੀ ਚਾਅ ਹੋਣਾ ਚਾਹੀਦਾ ਵਾ ਅਤੇ ਕਿਸੇ ਨੂੰ ਵੀ ਮੱਥੇ ਵੱਟ ਨਹੀਂ ਪਾਉਣਾ ਚਾਹੀਦਾ ਮਹਿਮਾਨ ਆਉਣ 'ਤੇ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਮੈਂ ਬਾ ਮਤਲਬ ਕਿ ਚੀਜ਼ਾਂ ਬਹੁਤ ਹੀ ਸੋਹਣੀਆਂ ਬਣਾ ਕੇ ਦੇਈ ਦੀਆਂ ਨਾ ਪਕਵਾਨ 'ਚ ਜਿੱਦਾਂ ਕਿ ਮਿੱਠੇ ਚੌਲ ਦਹੀਂ ਚੌਲ ਲੂਣ ਦਹੀਂ ਚੌਲ ਲੂਣ ਵਾਲੇ ਚੌਲ ਮਤਲਬ ਕਿ ਹਰੋ ਹੋਰ ਵੀ ਚੀਜ਼ਾਂ ਮੇਰਾ ਪੇਸ਼ਾ ਵਾ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਵੀ ਮੈਂ ਕੇ ਬਣੋ ਮੈਨੂੰ ਕੋਈ ਖਾਣਾ ਬਣਾਉਣ ਵੇਲੇ ਵੀ ਮੈਂ ਥੱਕ ਗਈ ਹਾਂ ਜਾਂ ਕੁਛ ਆ ਮੈਨੂੰ ਬਹੁਤ ਹੀ ਸ਼ੌਕ ਆ ਵੀ ਮੈਂ ਚੰਗੀਆਂ ਚੰਗੀਆਂ ਚੀਜ਼ਾਂ ਬਣਾ ਕੇ ਸਾਰਿਆਂ ਦੇ ਸਾਹਮਣੇ ਰੱਖਾਂ